ਮੈਂ ਸਿਲਾਈ ਦੀ ਜਾਂਚ ਆਪਣੀ ਦਾਦੀ ਮਾਂ ਤੋਂ ਸਿੱਖੀ ਜਦੋਂ ਮੈਂ ਬਾਰਵੀਂ ਕਕਸ਼ਾ ਜਦੋਂ ਮੈਂ ਬਾਰਵੀਂ ਜਮਾਤ ਪਾਸ ਕੀਤੀ ਸੀ ਉਹਨਾਂ ਨੇ ਮੈਨੂੰ ਸੂਟ ਸੀਨੇ ਸਿਖਾਏ ਮੇਰੀ ਮੈਂ ਆਪਣੇ ਪਾਪਾ ਲਈ ਵੀ ਇੱਕ ਕਮੀਜ਼ ਵੀ ਸੀਤੀ ਜਿਸ ਦੀ ਯਾਦ ਮੈਨੂੰ ਅੱਜ ਤੱਕ ਹੈ ਮੇਰੇ ਪਾਪਾ ਜੀ ਉਸਨੂੰ ਪਾ ਕੇ ਬਹੁਤ ਖੁਸ਼ ਹੋਏ ਉਹਨਾਂ ਨੇ ਮੈਨੂੰ ਵੱਖ ਵੱਖ ਕਈ ਤਰ੍ਹਾਂ ਦੇ ਕੱਪੜੇ ਸੀਨੇ ਸਿਖਾਏ ਜਿਵੇਂ ਬੱਚਿਆਂ ਦੇ ਛੋਟੇ ਛੋਟੇ ਫਰਾਕਾਂ ਫਿਰ ਮੈਂ ਓ ਫਰਾਕਾਂ ਆਪਣੇ ਮਾਮਾ ਜੀ ਦੇ ਬੱਚਿਆਂ ਨੂੰ ਸੀਕੇ ਦਿੱਤੀਆਂ ਆਪਣੇ ਚਾਚਾ ਜੀ ਦੀ ਬੇਟੀ ਵਾਸਤੇ ਸੀਤੀਆਂ ਆਪਣੀ ਤਾਇਆ ਜੀ ਵਾਸਤੇ ਮੈਂ ਇੱਕ ਕੁੜਤਾ ਪਜਾਮਾ ਵੀ ਸੀਤਾ ਮੈਂ ਆਪਣੀ ਮੰਮੀ ਨੂੰ ਸੂਟ ਸੀ ਕੇ ਦਿੱਤੇ ਕਿਉਂਕੀ ਮੇਰੀ ਮੰਮੀ ਨੂੰ ਸੂਟ ਸੀਨੇ ਨਹੀਂ ਆਉਂਦੇ ਸਨ ਉਹ ਸੂਟ ਜਦ ਮੈਂ ਸੀਤੇ ਤਾਂ ਉਹ ਵੇਖ ਕੇ ਮੇਰੇ ਮਾਤਾ ਜੀ ਬਹੁਤ ਖੁਸ਼ ਹੋਏ ਮੈਂ ਆਪਣੀ ਦਾਦੀ ਮਾਂ ਨੂੰ ਵੀ ਇੱਕ ਸੂਟ ਸੀ ਕੇ ਦਿੱਤਾ ਫਿਰ ਕੁਛ ਚੁੰਨੀਆਂ ਤੇ ਵੱਖ ਵੱਖ ਤਰ੍ਹਾਂ ਦੀਆਂ ਲੈਸਾਂ ਲਗਾਈਆਂ ਤਰਾਂ ਤਰਾਂ ਦੇ ਮੈਂ ਸੂਟ ਸੀਤੇ ਤਾਂ ਮੈਂ ਥੋੜਾ ਜਿਹਾ ਏ ਇਹ ਜਿਹੜੀ ਸਾਰੀ ਸਿਖਲਾਈ ਸੀ ਇਹ ਮੇਰੀ ਦਾਦੀ ਨੇ ਮੈਨੂੰ ਬੜੀ ਚੰਗੀ ਤਰਾਂ ਸਿਖਾਈ ਇਹ ਮੈਨੂੰ ਅੱਜ ਤੱਕ ਵੀ ਯਾਦ ਹੈ ਜਦ ਮੇਰੇ ਆਪਦੇ ਬੱਚੇ ਹੋਏ ਤਾਂ ਮੈਂ ਆਪਣੇ ਬੱਚਿਆਂ ਲਈ ਵੀ ਉਹਨਾਂ ਦੇ ਫੋਲ ਕੇ ਸੀਤੇ ਉਹਨਾਂ ਦੇ ਲੰਗੋਟ ਸੀਤੇ ਉਹਨਾਂ ਦੀਆਂ ਪਜਾਮੀਆਂ ਸੀਤੀਆਂ ਉਹਨਾਂ ਵਾਸਤੇ ਅਲੱਗ ਅਲੱਗ ਤਰ੍ਹਾਂ ਦੇ ਵਸਤਰ ਬਣਾਏ ਮੈਂ ਆਪਣੀ ਬੇਟੀ ਵਾਸਤੇ ਵੀ ਉਸ ਤਰ੍ਹਾਂ ਦੇ ਕਈ ਕੱਪੜੇ ਸੀਤੇ ਮੈਂ ਅੱਜ ਵੀ ਜਦੋਂ ਗਰਮੀਆਂ ਆਉਂਦੀਆਂ ਹਨ ਤੇ ਆਪਣੀ ਧੀ ਵਾਸਤੇ ਆਪਣੇ ਹੱਥੀ ਹੀ ਇਹ ਕੱਪੜੇ ਬਣਾਉਂਦੀ ਹਾਂ ਤੇ ਮੇਰੀ ਬੇਟੀ ਵੀ ਉਹ ਕੱਪੜੇ ਪਾ ਕੇ ਬਹੁਤ ਖੁਸ਼ ਹੁੰਦੀ ਹੈ ਤੇ ਸਭ ਨੂੰ ਬਹੁਤ ਚੰਗਾ ਲੱਗਦਾ ਹੈ ਧੰਨਵਾਦ